ਮੈਂ ਬਾਗਬਾਨੀ ਉਦੋਂ ਸ਼ੁਰੂ ਕੀਤੀ ਜਦੋਂ ਕਰੋਨਾ ਕਾਲ ਸੀ ਕਰੋਨਾ ਕਾਲ 'ਚ ਘਰ ਦੇ ਅੰਦਰ ਬੰਦ ਹੋ ਕੇ ਰਹਿਣਾ ਪੈਂਦਾ ਸੀ ਅਤੇ ਆਉਣਾ ਜਾਣਾ ਤਾਂ ਬਾਹਰ ਹੁੰਦਾ ਨਹੀਂ ਸੀ ਅਤੇ ਘਰ ਰਹਿ ਰਹਿ ਕੇ ਬਿਲਕੁਲ ਬੋਰ ਹੋ ਚੁੱਕੇ ਸਾਂ ਅਤੇ ਇੰਨਾਂ ਟਾਈਮ ਹੁੰਦਾ ਸੀ ਕਿ ਉਹਨੂੰ ਕਿਵੇਂ ਪ੍ਰਯੋਗ ਕੀਤਾ ਜਾਵੇ ਇਹ ਦਿਮਾਗ਼ 'ਚ ਰਹਿੰਦਾ ਸੀ ਅਤੇ ਉਦੋਂ ਮੈਂ ਸੋਚਿਆ ਕਿਉਂ ਨਾ ਬਾਗਬਾਨੀ ਸ਼ੁਰੂ ਕਰ ਦਿੱਤੀ ਜਾਵੇ ਅਤੇ ਉਦੋਂ ਹੀ ਮੈਂ ਆਪਣੇ ਘਰ ਦੇ ਵਿੱਚ ਗਮਲਿਆਂ ਦੇ ਵਿੱਚ ਚੰਗੀ ਤਰ੍ਹਾਂ ਮਿੱਟੀ ਪਾ ਕੇ ਅਤੇ ਧਨੀਆ ਪੁਦੀਨਾ ਵਗੈਰਾ ਉਗਾਇਆ ਅਤੇ ਕਈ ਤਰ੍ਹਾਂ ਦੇ ਫੁੱਲ ਪੌਦੇ ਉਗਾਏ ਅਤੇ ਨਿੱਕੀਆਂ ਮੋਟੀਆਂ ਸਬਜ਼ੀਆਂ ਵੀ ਮੈਂ ਗਮਲਿਆਂ 'ਚ ਹੀ ਲਗਾਈਆਂ ਅਤੇ ਉਦੋਂ ਮੈਂ ਬਾਗਬਾਨੀ ਸ਼ੁਰੂ ਕੀਤੀ ਸੀ ਅਤੇ ਅੱਜ ਇਹ ਮੇਰਾ ਇੱਕ ਚੰਗਾ ਸ਼ੌਂਕ ਬਣ ਚੁੱਕਿਆ ਹੈ ਠੀਕ ਹੈ